ਭੰਗੜੇ ਦੇ ਪਹਿਰਾਵੇ ਦੀ ਗੱਲ ਕਰੀਏ ਤਾਂ ਕੁੜਤਾ ਚਾਦਰਾ ਪਹਿਚਾਣ ਪਹਿਨਿਆ ਜਾਂਦਾ ਹੈ ਪੈਰਾਂ ਵਿੱਚ ਜੁੱਤੀ ਪਾਈ ਜਾਂਦੀ ਹੈ ਸਿਰ 'ਤੇ ਦਸਤਾਰ ਸਜਾਈ ਜਾਂਦੀ ਹੈ ਅਤੇ ਦਸਤਾਰ ਦੇ ਉੱਤੇ ਤੁਰਲਾ ਲਾਇਆ ਜਾਂਦਾ ਹੈ ਗਲ ਦੇ ਵਿੱਚ ਕੈਂਠਾ ਪਾਇਆ ਜਾਂਦਾ ਹੈ ਅਤੇ ਜਿਹੜਾ ਭੰਗੜਾ ਹੈ ਉਹ ਡਾਂਸ ਕਰਨ ਨੂੰ ਕਿ ਹੋਰ ਆਕਰਸ਼ਿਤ ਕਿਵੇਂ ਕਰਦਾ ਕਿਉਂਕਿ ਜਿਹੜਾ ਉਹਨਾਂ ਦਾ ਪਹਿਰਾਵਾ ਹੁੰਦਾ ਪੰਜਾਬੀ ਪਹਿਰਾਵਾ ਹੁੰਦਾ ਅਤੇ ਦੂਸਰਿਆਂ ਨੂੰ ਸੋਹਣਾ ਬੜਾ ਲੱਗਦਾ ਇਸ ਕਰਕੇ ਉਹ ਉਹਨਾਂ ਨੂੰ ਆਕਰਸ਼ਿਤ ਕਰਦਾ ਅਤੇ ਜਿਹੜੇ ਡਾਂਸ ਕਰਨ ਵਾਲੇ ਹੁੰਦੇ ਆ ਭੰਗੜੇ ਵਾਲੇ ਵੀਰ ਹੁੰਦੇ ਆ ਉਹਨਾਂ ਦੀਆਂ ਮੁੱਛਾਂ ਖੁੰਡੀਆਂ ਹੁੰਦੀਆਂ ਨੇ ਦਾੜੀ ਹੁੰਦੀ ਹੈ ਮੁੱਛਾਂ ਖੁੰਡੀਆਂ ਕਾਰਨ ਦਾੜੀ ਦੇ ਕਾਰਨ ਉਹ ਹੋਰ ਵੀ ਮਨ ਨੂੰ ਅਕਰਸ਼ਿਤ ਕਰਦਾ ਹੈ ਅਤੇ ਬਹੁਤ ਸੋਹਣਾ ਹੈ